ਸਰ ਹਾਂ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਮੇਰਾ ਨਾਮ ਰਾਜਵਿੰਦਰ ਕੌਰ ਹੈ ਮੈਨੂੰ ਆਪਣੇ ਮਤਲਬ ਘੁੰਮਣ ਫਿਰਨ ਦਾ ਬਹੁਤ ਸ਼ੌਕ ਆ ਮੈਨੂੰ ਆਪਣੇ ਮਨ ਪਸੰਦ ਦੇ ਇਲਾਕੇ ਦੇ ਵਿੱਚ ਰਹਿਣਾ ਬੜਾ ਪਸੰਦ ਆ ਸ਼ਾਂਤੀ ਸ਼ਾਂਤੀ ਜਿਹਾ ਇਲਾਕਾ ਹੋਏ ਮਾਹੌਲ ਹੋਵੇ ਬਰਫ ਬਰਫ ਹੋਵੇ ਪਹਾੜਾਂ ਵਿੱਚ ਰਹਿਣ ਦਾ ਜਾਣ ਦਾ ਬੜਾ ਸ਼ੌਕ ਆ ਇੰਜੋਏ ਕਰਨ ਦਾ ਬਹੁਤ ਜ਼ਿਆਦਾ ਸ਼ੌਕ ਹੁੰਦਾ ਮੈਨੂੰ ਤਾਂ ਕਿ ਜਦੋਂ ਵੀ ਮੈਂ ਆਪਾਂ ਸੋਚਦੇ ਹਾਂ ਕਿ ਅਸੀਂ ਮਤਲਬ ਆਪਣਾ ਇੰਜੋਏ ਕਰੀਏ ਆਹ ਇੱਥੇ ਚੱਲੀਏ ਆਪਣੇ ਪਹਾੜਾਂ ਵਿੱਚ ਚੱਲੀਏ ਜਾਂ ਕਿਤੇ ਵੀ ਜੰਗਲ ਜੰਗਲ ਦੇ ਇਲਾਕੇ ਵਿੱਚ ਜਾਣਾ ਜਾਂ ਬਗੀਚੇ ਵਿੱਚ ਜਾਣਾ ਕਿ ਕਿ ਬਹੁਤ ਵਧੀਆ ਲੱਗਦਾ ਸਾਨੂੰ ਆਪਣਾ ਮਨ ਪਸੰਦ ਦਾ ਰਹਿਣ ਸਹਿਣ ਕਰਨਾ ਚਾਹੀਦਾ ਕਿ ਜੰਗਲਾਂ ਵਿੱਚ ਜਾ ਕੇ ਸਾਨੂੰ ਆਪਣੇ ਬਰਫੀਲੇ ਪਹਾੜਾ ਵਿੱਚ ਜਾ ਕੇ ਸਾਨੂੰ ਆਪਣਾ ਇੰਜੋਏ ਕਰਨਾ ਚਾਹੀਦਾ ਰਹਿਣ ਰਹਿਣਾ ਚਾਹੀਦਾ ਆਪਣਾ ਪੂਰਾ ਫੁੱਲ ਇੰਜੋਏ ਕਰਦੇ ਹਾਂ ਅਸੀਂ ਆਹ ਸਾਨੂੰ ਆਪਣੀ ਮੰਨ ਪਸੰਦ ਦੇ ਇਲਾਕਿਆਂ ਵਿੱਚ ਵੀ ਜਾਣਾ ਚਾਹੀਦਾ ਹੈ ਅਤੇ ਤਾਂ ਕਿ ਪਹਾੜਾਂ ਦੇ ਪਹਾੜਾਂ ਦੇ ਬਰਫੀਲੇ ਇਲਾਕੇ ਬਹੁਤ ਸਾਨੂੰ ਜਿਸ ਤਰ੍ਹਾਂ ਸਾਡੇ ਇੱਧਰ ਬਹੁਤ ਗਰਮੀ ਹੁੰਦੀ ਹੈ ਸਾਨੂੰ ਜਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਸ਼ਿਮਲੇ ਆਪਣੇ ਠੰਢੇ ਇਲਾਕੇ ਵਿੱਚ ਘੁੰਮਣ ਜਾਂਦੇ ਹਾਂ ਬਰਫੀਲੇ ਇਲਾਕੇ ਵਿੱਚ ਜਾਂਦੇ ਹਾਂ ਅਤੇ ਅਸੀਂ ਅਸੀਂ ਜਦੋਂ ਸਾਨੂੰ ਛੁੱਟੀਆਂ ਹੁੰਦੀਆਂ ਅਸੀਂ ਆਪਣੇ ਘੁੰਮਣ ਫਿਰਨ ਨੂੰ ਬਹੁਤ ਇੰਜੋਏ ਕਰਦੇ ਹਾਂ ਅਤੇ ਸਾਨੂੰ ਜਦੋਂ ਵੀ ਅਸੀਂ ਆਪਣੇ ਜੰਗਲਾਂ ਵਿੱਚ ਜਾਂਦੇ ਹਾਂ ਅਤੇ ਅਸੀਂ ਅਸੀਂ ਕੀ ਪਸੰਦ ਕਰਦੇ ਹਾਂ ਕਿ ਸਾਨੂੰ ਸੰਘਣੇ ਉੱਥੇ ਦਰਖਤ ਹੋਣੇ ਚਾਹੀਦੇ ਹਨ ਬਹੁਤ ਸਾਰੀ ਛਾਂ ਹੋਣੀ ਚਾਹੀਦੀ ਹੈ ਸ਼ਾਂਤੀ ਜਿਹਾ ਮਾਹੌਲ ਹੋਣਾ ਚਾਹੀਦਾ ਬਹੁਤ ਸਾਰਾ ਵਧੀਆ ਤਰੀਕੇ ਨਾਲ ਅਸੀਂ ਘੁੰਮ ਫਿਰ ਸਕੀਏ ਆਪਣੇ ਸਾਰੇ ਪਸੰਦ ਦੇ ਹਰ ਇੱਕ ਤਰੀਕੇ ਦੇ ਨਾਲ ਆਪਾਂ ਘੁੰਮ ਸਕਦੇ ਹਾਂ